ਹੈਲੋ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ

ਤਿੰਨ ਦਿਨ ਵਾਸਤੇ ਸਰ ਇਹਦਾ ਪੈਕਜ ਹੁੰਦਾ ਜੇ ਦਸ ਹਜ਼ਾਰ ਦਾ ਹੈਗਾ ਜੇ ਸਾਡਾ ਨਾ ਇੱਕ ਟੂਰਿਸਟ ਗਾਈਡ ਹੁੰਦਾ ਜਿਹੜਾ ਚੌਵੀ ਘੰਟੇ ਤੁਹਾਡੇ ਨਾਲ ਰਹੇਗਾ ਉਹ ਚੌਵੀ ਘੰਟੇ ਤੁਹਾਡੇ ਨਾਲ ਰਹੇਗਾ ਉਹ ਤੁਹਾਨੂੰ ਇੱਥੋਂ ਜਿਵੇਂ ਦਰਬਾਰ ਸਾਹਿਬ ਹੋ ਗਿਆ ਜਲਿਆਂਵਾਲਾ ਬਾਗ ਹੋ ਗਿਆ ਗੋਬਿੰਦਗੜ ਕਿਲ੍ਹਾ ਹੋ ਗਿਆ ਸਾਡਾ ਪਿੰਡ ਹੋ ਗਿਆ ਅਤੇ ਵੱਖ ਵੱਖ ਥਾਵਾਂ 'ਤੇ ਤੁਹਾਨੂੰ ਘੁੰਮਾਏਗਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਡਨ ਜੀ